ਸਾਡੇ ਪੰਜਾਬ ਦੇ ਇੰਡਸਟਰੀ ਵਿੱਚ ਬਹੁਤ ਹੀ ਸਾਰੇ ਸਿੰਗਰ ਹਨ ਪਰ ਮੈਨੂੰ ਤਰਸੇਮ ਜੱਸਰ ਬਹੁਤ ਹੀ ਵਧੀਆ ਲੱਗਦਾ ਹੈ ਉਸ ਦੀ ਐਕਟਿੰਗ ਬਹੁਤ ਹੀ ਵਧੀਆ ਹੈ ਅਤੇ ਉਸ ਦੇ ਗਾਣੇ ਸ ਬੋਲਣ ਦਾ ਗਾਉਣ ਦਾ ਤਰੀਕਾ ਬਹੁਤ ਹੀ ਜ਼ਿਆਦਾ ਵਧੀਆ ਹੈ ਪਰ ਉਹਦੀ ਗਲਵੱਕੜੀ ਮੂਵੀ ਇੰਨੀ ਜਿਆਦਾ ਵਧੀਆ ਹਿੱਟ ਅਤੇ ਇੰਨੀ ਜ਼ਿਆਦਾ ਫੇਮਸ ਹੋਈ ਹੈ ਜੋ ਕਿ ਫੈਮਿਲੀ ਨਾਲ ਦੇਖਣਯੋਗ ਹੈ ਅਤੇ ਬਹੁਤ ਹੀ ਵਧੀਆ ਫਿਲਮ ਹੈ